ਮੇਰਾ ਸਭ ਤੋਂ ਉੱਚਾ ਰਿਕਾਰਡ ਇੱਕ ਘੰਟਾ ਦਸ ਮਿੰਟ ਦੌੜਨਾ ਹੈ ਵੈਸੇ ਮੈਂ ਹਰ ਰੋਜ਼ ਚਾਲ੍ਹੀ ਮਿੰਟ ਦੌੜਦੀ ਹਾਂ ਪਰ ਮੇਰਾ ਸਭ ਤੋਂ ਉੱਚਾ ਰਿਕਾਰਡ ਇੱਕ ਘੰਟਾ ਦਸ ਮਿੰਟਾਂ ਦਾ ਹੈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਯਮਤ ਤੌਰ 'ਤੇ ਕਸਰਤ ਕਰਨੀ ਚਾਹੀਦੀ ਹੈ ਅਤੇ ਦੌੜਨਾ ਚਾਹੀਦਾ ਹੈ ਸੈਰ ਕਰਨ ਦੇ ਬਹੁਤ ਫਾਇਦੇ ਹਨ ਇਸ ਨਾਲ ਸਾਡਾ ਸਰੀਰ ਫਿਟ ਰਹਿੰਦਾ ਹੈ ਸਿਹਤ ਮਾਹਿਰ ਹਮੇਸ਼ਾ ਸਿਹਤਮੰਦ ਰਹਿਣ ਲਈ ਕਸਰਤ ਕਰਨ ਦੀ ਸਲਾਹ ਦਿੰਦੇ ਹਨ ਜਦੋਂ ਸਾਨੂੰ ਸਭ ਤੋਂ ਆਸਾਨ ਅਤੇ ਵਧੀਆ ਕਸਰਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਤੁਰਨ ਜਾਂ ਦੌੜਨ ਦਾ ਨਾਮ ਸਭ ਤੋਂ ਪਹਿਲਾਂ ਲੈਂਦੇ ਹਾਂ ਤੁਸੀਂ ਨਿਯਮਤ ਤੌਰ 'ਤੇ ਦੌੜ ਕੇ ਜਾਂ ਸੈਰ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ ਜਦੋਂ ਸਭ ਤੋਂ ਵਧੀਆ ਗੱਲ ਆਉਂਦੀ ਹੈ ਕਿ ਲੋਕ ਉਲਝਣ ਵਿੱਚ ਪੈ ਜਾਂਦੇ ਹਨ ਕਿ ਪੈਦਲ ਚੱਲਣਾ ਜਾਂ ਦੌੜਨਾ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਬਿਹਤਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਿਟਨੈਸ ਦੇ ਲਿਹਾਜ਼ ਨਾਲ ਸਾਨੂੰ ਦੋਵੇਂ ਕਸਰਤਾਂ ਸਭ ਤੋਂ ਵਧੀਆ ਹਨ ਹਾਲਾਂਕਿ ਇਹਨਾਂ ਦਾ ਸਿਹਤ 'ਤੇ ਵੱਖ ਵੱਖ ਪ੍ਰਭਾਵ ਪੈਂਦਾ ਹੈ ਆਓ ਜਾਣਦੇ ਹਾਂ ਕਿ ਪੈਦਲ ਚੱਲਣ ਅਤੇ ਦੌੜਨ ਦੀ ਸਿਹਤ ਲਈ ਕੀ ਕੀ ਫਾਇਦੇ ਹਨ ਸਿਹਤ ਨੂੰ ਫਿੱਟ ਰੱਖਣ ਲਈ ਸੈਰ ਕਰਨਾ ਜ਼ਰੂਰੀ ਹੈ ਇਸ ਨਾਲ ਤੁਹਾਡਾ ਸਰੀਰ ਜਿਹੜਾ ਕਿਰਿਆਸ਼ੀਲ ਰਹਿੰਦਾ ਹੈ ਅਤੇ ਭੋਜਨ ਠੀਕ ਤਰ੍ਹਾਂ ਪਚਦਾ ਹੈ ਜਿਹਨਾਂ ਲੋਕਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਲਗਾਤਾਰ ਸੈਰ ਕਰਨੀ ਚਾਹੀਦੀ ਹੈ ਤਨਾਅ ਚਿੰਤਾ ਨੀਂਦ ਦੀ ਕਮੀ ਜਾਂ ਇਕਾਗਰਤਾ ਦੀ ਕਮੀ ਨੂੰ ਦੂਰ ਕਰਨ ਲਈ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ ਬਿਮਾਰ ਅਤੇ ਬਜ਼ੁਰਗ ਜੋ ਜ਼ਿਆਦਾ ਕਸਰਤ ਨਹੀਂ ਕਰ ਸਕਦੇ ਉਹ ਪੈਦਲ ਚੱਲਣ ਨਾਲ ਸਿਹਤ ਲਾਭ ਪ੍ਰਾਪਤ ਕਰ ਸਕਦੇ ਹਨ ਸੈਰ ਕਰਨ ਦਾ ਇੱਕ ਫਾਇਦਾ ਇਹ ਵੀ ਹੈ ਕਿ ਤੁਸੀਂ ਇਸ ਕਸਰਤ ਨੂੰ ਕਿਸੇ ਵੀ ਉਮਰ ਵਿੱਚ ਕਰ ਸਕਦੇ ਹੋ ਦੌੜਨ ਦੌੜਨ ਦਾ ਫਾਇਦਾ ਇਹ ਹੈ ਕਿ ਦੁਨੀਆਂ ਵਿੱਚ ਮੋਟਾਪਾ ਤੇਜ਼ੀ ਨਾਲ ਵੱਧ ਰਿਹਾ ਦੌੜਨ ਦੇ ਨਾਲ ਸਾਡਾ ਭਾਰ ਘੱਟ ਹੁੰਦਾ ਸਾਡੀ ਕੈਲਰੀ ਅਤੇ ਚਰਬੀ ਵਰਨ ਹੁੰਦੀ ਹੈ ਇਸ ਲਈ ਮੋਟਾਪਾ ਘੱਟਦਾ ਹੈ ਸਾਡੇ ਖੂਨ ਦਾ ਸੰਚਾਰ ਸਹੀ ਰਹਿੰਦਾ ਹੈ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਸ ਕਰਕੇ ਦੌੜਨ ਅਤੇ ਸੈਰ ਕਰਨ ਦੇ ਦੋਵਾਂ ਦੇ ਆਪਣੇ ਆਪਣੇ ਫਾਇਦੇ ਹਨ